ਪੁਰਾਣੇ ਸਮਿਆਂ ਵਿੱਚ ਖੂਹਾਂ ਤੋਂ ਹੀ ਜ਼ਿਆਦਾਤਰ ਲੋਕ ਪਾਣੀ ਕੱਢ ਕੇ ਹੀ ਪੀਂਦੇ ਸੀ ਇਸ ਨਾਲ ਲੋਕਾਂ ਦੇ ਸਰੀਰ ਦੀ ਕਸਰਤ ਵੀ ਹੋ ਜਾਂਦੀ ਸੀ ਅਤੇ ਸਰੀਰ ਤੰਦਰੁਸਤ ਰਹਿੰਦਾ ਸੀਗਾ ਇਹਨਾਂ ਸਮਿਆਂ ਵਿੱਚ ਖੂਹ ਵਿੱਚੋਂ ਪਾਣੀ ਕੱਢਣ ਲਈ ਬਲਦਾਂ ਨਾਲ਼ ਹਲਟੀ ਜੋੜ ਕੇ ਪਾਣੀ ਖੂਹ ਵਿੱਚੋਂ ਕੱਢਿਆ ਜਾਂਦਾ ਸੀ ਕਈ ਥਾਵਾਂ ਉੱਤੇ ਹੱਥਾਂ ਨਾਲ਼ ਧਰਤੀ ਵਿੱਚੋਂ ਬਹੁਤ ਡੂੰਘੇ ਡੂੰਘੇ ਟੋਏ ਪੁੱਟ ਕੇ ਨਲਕੇ ਲਗਾਏ ਜਾਂਦੇ ਸੀ ਪਰ ਹੁਣ ਸਮਾਂ ਬਦਲ ਚੁੱਕਿਆ ਹੈ ਖੂਹਾਂ ਅਤੇ ਨਲ਼ਕਿਆਂ ਦੀ ਵਰਤੋਂ ਬਹੁਤ ਘੱਟ ਗਈ ਹੈ ਅੱਜ ਦੇ ਸਮੇਂ ਵਿੱਚ ਖੂਹ ਕਿਤੇ ਕਿਤੇ ਦੇਖਣ ਨੂੰ ਹੀ ਮਿਲਦਾ ਹੈ ਬਦਲਦੇ ਸਮੇਂ ਦੇ ਨਾਲ਼ ਬਹੁਤ ਸਾਰੇ ਉਪਕਰਨ ਆ ਗਏ ਹਨ ਜਿਨ੍ਹਾਂ ਦੁਆਰਾ ਧਰਤੀ 'ਚੋਂ ਪਾਣੀ ਆਸਾਨੀ ਨਾਲ਼ ਕੱਢਿਆ ਜਾ ਸਕੇ ਜਿਵੇਂ ਕਿ ਇਹਨਾਂ ਦੀ ਵਿੱਚ ਇਲੈਕਟ੍ਰੋਨਿਕ ਮੋਟਰ ਸਵਰਸੀਬਲ ਬੋਰ ਅਤੇ ਪੰਪਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨਾਲ਼ ਸਮੇਂ ਦੀ ਵਰਤੋਂ ਬਹੁਤ ਘੱਟ ਗਈ ਹੈ ਇਹ ਸਾਰੇ ਉਪਕਰਨ ਬਿਜਲੀ ਦੀ ਵਰਤੋਂ ਨਾਲ ਚੱਲਦੇ ਹਨ ਇਸ ਨਾਲ਼ ਲੋਕਾਂ ਦੀ ਜ਼ਿੰਦਗੀ ਬੜੀ ਸਿਖਾਲੀ ਅਤੇ ਵਧੀਆ ਹੋ ਗਈ ਹੈ